ਸਾਡੇ ਇੱਥੇ ਖੇਤਰ ਦੇ ਵਿੱਚ ਜਦੋਂ ਕਹਿ ਲਉ ਕਿ ਸਾਡੇ ਸ਼ਹਿਰ 'ਚ ਇੰਜੀਨੀਅਰਿੰਗ ਕੋਲੇਜ ਖੁੱਲ੍ਹਿਆ ਉੱਨੀ ਸੌ ਤਰਾਨਵੇਂ ਦੇ ਵਿੱਚ ਅਤੇ ਇੰਜੀਨੀਅਰਿੰਗ ਕੋਲੇਜ ਖੁੱਲ੍ਹਣ ਦੇ ਨਾਲ ਨਾ ਉੱਥੇ ਫਤਿਹਗੜ੍ਹ ਸਾਹਿਬ ਇੱਕ ਮਾਰਕਿਟ ਡਿਵੈਲਪ ਹੋਈ ਨਵੀਂ ਇੰਜੀਨੀਅਰਿੰਗ ਕੋਲੇਜ ਦੇ ਸਾਹਮਣੇ ਜਿੱਥੇ ਕਿ ਬਹੁਤ ਲੋਕਾਂ ਨੂੰ ਉੱਥੇ ਕੰਮ ਕਰਨ ਨੂੰ ਮਿਲਿਆ ਅਤੇ ਕਿਸੇ ਨੇ ਦੁਕਾਨ ਖੋਲ੍ਹੀ ਕੋਈ ਉੱਥੇ ਦੁਕਾਨ 'ਤੇ ਕੰਮ ਲੱਗਿਆ ਜਿਸ ਕਰਕੇ ਉਹਨਾਂ ਦੀ ਰੋਜ਼ੀ ਚੱਲੀ ਬੰਦਿਆਂ ਦੀ ਉਸ ਤੋਂ ਬਾਅਦ ਯੂਨੀਵਰਸਿਟੀ ਖੁੱਲ੍ਹੀ ਉਰੇ ਅਤੇ ਯੂਨੀਵਰਸਿਟੀ ਕਰਕੇ ਵੀ ਲੋਕਾਂ ਨੂੰ ਬਹੁਤ ਕੰਮ ਮਿਲਿਆ ਜਿਵੇਂ ਕਿ ਜਿਹੜੇ ਬੱਚੇ ਦੂਰੋਂ ਨੇੜਿਓਂ ਪੜ੍ਹਨ ਆਉਂਦੇ ਨੇ ਤਾਂ ਉਹਨਾਂ ਦੇ ਰਿਹਾਇਸ਼ ਵਾਸਤੇ ਵੀ ਕੋਈ ਪੀ ਜੀ ਚਲਾ ਰਿਹਾ ਕੋਈ ਖਾਣਾ ਬਣਾ ਰਿਹਾ ਕੋਈ ਲੰਚ ਟਿਫ਼ਨ ਦੀ ਸਰਵਿਸ ਕਰ ਰਿਹਾ ਜਿਸ ਕਰਕੇ ਕਾਫ਼ੀ ਬੰਦਿਆਂ ਨੂੰ ਕੰਮ ਮਿਲਿਆ ਅਤੇ ਯਾਨੀ ਕਿ ਉਹਨਾਂ ਨੂੰ ਇਕਨੋਮਿਕਲੀ ਉਹਨਾਂ ਮਿਆਰ ਉੱਚਾ ਹੋਇਆ ਜਦੋਂ ਕਮਾਈ ਆਉਂਦੀ ਆਈ ਹੈ ਨਾ ਅਤੇ ਉਸ ਤੋਂ ਬਾਅਦ ਉਰੇ ਹੋਰ ਜਿਹੜੇ ਛੋਟੇ ਇੰਸਟੀਟਿਊਟ ਸੀ ਉਹ ਵੀ ਕਾਫ਼ੀ ਡਿਵੈਲਪ ਹੋਏ ਜਿਵੇਂ ਸਮੇਂ ਦੇ ਨਾਲ ਨਾਲ ਜਿਵੇਂ ਰਿਕੁਆਇਰਮੈਂਟ ਆਉਂਦੀ ਰਹੀ ਆਇਲਸ ਦੇ ਇੰਸਟੀਟਿਊਟ ਅਤੇ ਅਤੇ ਹੋਰ ਅਤੇ ਉਰੇ ਸਟੂਡੈਂਟਸ ਦੀ ਬਹੁਤ ਤਾਇਤ ਹੋਣ ਕਰਕੇ ਉਰੇ ਫਿਰ ਨਵੇਂ ਨਵੇਂ ਬ੍ਰੈਂਡਸ ਵੀ ਆ ਗਏ ਜਿਸ ਕਰਕੇ ਉਰੇ ਇੱਕ ਪੂਰੀ ਫੁੱਲ ਫਲੈਜਡ ਮਾਰਕਿਟ ਡਿਵੈਲਪ ਹੋ ਗਈ ਅਤੇ ਪਹਿਲਾਂ ਦੇ ਨਾਲੋਂ ਹੁਣ ਕਾਫ਼ੀ ਇੱਥੇ ਜਾਣੀ ਕਿ ਚਹਿਲ ਪਹਿਲ ਰਹਿੰਦੀ ਹੈ ਇਸ ਏਰੀਏ ਵਿੱਚ ਪਹਿਲਾਂ ਤਾਂ ਉਰੇ ਸ਼ਾਮ ਨੂੰ ਜਿਵੇਂ ਆਵਾਜਾਈ ਵੀ ਬੰਦ ਹੋ ਜਾਂਦੀ ਸੀ ਹੁਣ ਅ ਚਹਿਲ ਪਹਿਲ ਰਹਿੰਦੀ ਆ ਨਵੇਂ ਸਟੋਰ ਬਣਨ ਕਰਕੇ ਨਾ ਅਤੇ ਇਸ ਕਰਕੇ ਕਾਫ਼ੀ ਬਦਲਾਅ ਆਇਆ ਪਿਛਲੇ ਕੁਛ ਸਾਲਾਂ ਦੇ ਵਿੱਚ